ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਇੱਥੇ ਘੁੰਮਣ ਆਉਣਾ ਸੀ ਅਤੇ ਤੁਹਾਡੇ ਇੱਥੇ ਹੋਟਲ ਕਿਹੜਾ ਵਧੀਆ ਹੈ ਸਰ ਤੁਸੀਂ ਇਹ ਦੱਸ ਸਕਦੇ ਹੋ ਅੱਛਾ ਸਰ ਜਿਹੜਾ ਸਰਾਂ ਹੋਟਲ ਹੈ ਜੀ ਉਹਦਾ ਰੂ ਕਮਰਾ ਵਗੈਰਾ ਕਿਵੇਂ ਦਾ ਹੈ ਏਸੀ ਵਾਲਾ ਹੈ ਕਿ ਬਿਨਾਂ ਏਸੀ ਤੋਂ ਹੈ ਅੱਛਾ ਜੀ ਅਤੇ ਖਾਣਾ ਪੀਣਾ ਕਿਵੇਂ ਦਾ ਹੈ ਠੀਕ ਹੈ ਜੀ ਅਤੇ ਕਿੰਨੇ ਵਜੇ ਤੱਕ ਖੁੱਲ੍ਹਾ ਰਹਿੰਦਾ ਇਹ ਹੋਟਲ ਅੱਛਾ ਜੀ ਅਤੇ ਓਹਨੂੰ ਕੀ ਕਹਿੰਦੇ ਇਹਦਾ ਜਿਹੜਾ ਕਮਰੇ ਦਾ ਉਹ ਉਹ ਪੈਸੇ ਪੂਸੇ ਕਿੰਨੇ ਹੈ ਜੀ ਪੈਸੇ ਕਿੰਨੇ ਹੈ ਜੀ ਰੈਂਟ ਜੀ ਰੈਂਟ ਹਾਂਜੀ ਜੀ ਅੱਛਾ ਜੀ ਅੱਛਾ ਜੀ ਤੇ ਚਲੋ ਕੋਈ ਗੱਲ ਨਹੀਂ ਅਤੇ ਠੀਕ ਹੈ ਜੀ ਜਿਹੜਾ ਉਹ ਜੀ ਏ ਸੀ ਵਾਲਾ ਐੱਲ ਈ ਡੀ ਵਗੈਰਾ ਲੱਗੀ ਵੀ ਹੈ ਅਤੇ ਸਫ਼ਾਈ ਵਗੈਰਾ ਕਿਵੇਂ ਦੀ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਫਿਰ ਮੈ ਤੁਹਾਨੂੰ ਉਹ ਦੱਸ ਦੱਸ ਦੂੰਗੀ ਠੀਕ ਠੀਕ ਹੈ ਜੀ ਸਰਵਿਸ ਖਾਣੇ ਦੀ ਰੂਮ ਵਿਚ ਆ ਜਾਂਦੀ ਹੈ ਸਰਵਿਸ ਜਿਵੇਂ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ